ਪਰਿਵਾਰ ਅਤੇ ਸ਼ੌਂਕ ਇਹ ਦੋਵੇਂ ਜ਼ਿੰਦਗੀ ਦੇ ਮਹੱਤਵਪੂਰਨ ਹਿੱਸੇ ਹਨ ਮੈਂ ਬਾਈਕਿੰਗ ਦੇ ਸ਼ੌਂਕ ਨੂੰ ਪਰਿਵਾਰਿਕ ਸਮ ਜ਼ਿੰਮੇਵਾਰੀਆਂ ਦੇ ਨਾਲ ਸੰਤੁਲਿਤ ਰੱਖਣ ਲਈ ਸਮੇਂ ਦੀ ਯੋਜਨਾ ਬਣਾਉਂਦਾ ਹਾਂ ਜਦੋਂ ਪਰਿਵਾਰ ਦੀ ਪਹਿਲ ਹੋਵੇ ਉਦੋਂ ਉਹਨਾਂ ਦੇ ਨਾਲ ਵਧੀਆ ਸਮਾਂ ਬਤਾਉਂਦਾ ਹਾਂ ਪਰ ਜਦੋਂ ਮੇਰੇ ਕੋਲ ਖਾਲੀ ਸਮਾਂ ਹੁੰਦਾ ਹੈ ਤਾਂ ਮੈਂ ਬਾਈਕਿੰਗ ਦਾ ਅਨੰਦ ਲੈਂਦਾ ਹਾਂ ਕਈ ਵਾਰ ਮੈਂ ਆਪਣੇ ਪਰਿਵਾਰ ਨੂੰ ਵੀ ਛੋਟੇ ਟ੍ਰਿਪਸ 'ਤੇ ਲੈ ਜਾਂਦਾ ਹਾਂ ਤਾਂ ਜੋ ਦੋਵੇਂ ਚੀਜ਼ਾਂ ਨੂੰ ਮਿਲਾ ਸਕਾਂ ਸ਼ਾਮ ਦੇ ਸਮੇਂ ਜਾਂ ਹਫ਼ਤੇ ਦੇ ਆਖਰੀ ਦਿਨ ਬਾਈਕਿੰਗ ਲਈ ਚੰਗੇ ਰਹਿੰਦੇ ਹਨ ਤਾਂ ਕਿ ਦਿਨਾਂ ਦੇ ਕੰਮਾਂ 'ਚ ਕੋਈ ਰੁਕਾਵਟ ਨਾ ਆਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਿਵਾਰ ਦੀ ਸਮਝਦਾਰੀ ਅਤੇ ਮੇਰੀ ਪਸੰਦ ਦੀ ਸਹਿਮਤੀ ਹੋਣੀ ਚਾਹੀਦੀ ਹੈ ਜਦੋਂ ਪਰਿਵਾਰ ਅਤੇ ਸ਼ੌਂਕ ਵਿੱਚ ਇੱਕ ਸੰਤੁ ਸੰਤੁਲਨ ਬਣ ਜਾਵੇ ਤਾਂ ਦੋਵੇਂ ਚੀਜ਼ਾਂ ਬਿਨਾਂ ਕਿਸੇ ਤਣਾਅ ਦੇ ਚੱਲਦੀਆਂ ਰਹਿੰਦੀਆਂ ਹਨ